ਸਤਿ ਸ਼੍ਰੀ ਅਕਾਲ ਜੀ ਭਾਰਤ ਦੀ ਸੰਸਕ੍ਰਿਤ ਜਿਵੇਂ ਆਪਾਂ ਜਾਣਦੇ ਹਾਂ ਬਹੁਤ ਸਾਰੇ ਡਾਂਸਰ ਜਿਵੇਂ ਭਰਤਨਾਟਮ ਗਰਬਾ ਵਗੈਰਾ ਇਹ ਸਾਡੀ ਪੂਜਾ ਵਿਧੀ 'ਚ ਵੀ ਵਰਤਿਆ ਜਾਂਦਾ ਜਿਵੇਂ ਆਪਾਂ ਦੇਖਦੇ ਹਾਂ ਵੀ ਨਵਰਾਤਰਿਆਂ ਦੇ ਟਾਈਮ ਗਰਬਾ ਜਾਂ ਡਾਂਸ ਕਰਦੇ ਹਾਂ ਫਿਰ ਆਪਾਂ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਸਾਰੇ ਨਾਟਕ ਨੇ ਗਿੱਧਾ ਭੰਗੜਾ ਲੂੰਗੀ ਝੂਮਰ ਆਦਿ ਹੈ ਨਾ ਤੇ ਫਿਰ ਹੁਣ ਜਿਹੜਾ ਚੰਗਾ ਡਾਂਸਰ ਬਣਨ ਲਈ ਕੀ ਕਰਨਾ ਚਾਹੀਦਾ ਚੰਗਾ ਡਾਂਸਰ ਹੈ ਜਿਹੜਾ ਉਹ ਇੱਕ ਆਪਣੇ ਅੰਦਰ ਪ੍ਰੇਰਨਾ ਹੋਣੀ ਚਾਹੀਦੀ ਹੈ ਡਾਂਸ ਸਿੱਖਣ ਦੀ ਵੀ ਆਪਾਂ ਕਿੱਦਾਂ ਦਾ ਡਾਂ ਵੀ ਆਪਣੇ ਅੰਦਰ ਜਜ਼ਬਾ ਹੋਵੇ ਵੀ ਹਾਂ ਅਸੀਂ ਡਾਂਸ ਸਿੱਖਣਾ ਜਾਂ ਅਸੀਂ ਡਾਂਸ ਕਰਨਾ ਵੀ ਜਦੋਂ ਵੀ ਕੋਈ ਕੰਮ ਕਰਨਾ ਉਹਦੀ ਪ੍ਰੇਰਨਾ ਹੋਣੀ ਬਹੁਤ ਜ਼ਰੂਰੀ ਆ ਅਤੇ ਫਿਰ ਉਹਦੀ ਫਿਜੀਕਲ ਫਿਟਨੈਸ ਹੋਣੀ ਚਾਹੀਦੀ ਉਹਦੇ ਅੰਦਰ ਫਿਜ਼ੀਕਲੀ ਫਿੱਟ ਹੋਵੇ ਸਰੀਰਿਕ ਤੌਰ 'ਤੇ ਵਧੀਆ ਹੋਵੇ ਹੈ ਨਾ ਉਹਦੀ ਫਿਟਨੈਸ ਨੂੰ ਧਿਆਨ ਰੱਖਣਾ ਹੋਵੇ ਵੀ ਜ਼ਿਆਦਾ ਉਹਦੀ ਕੋਈ ਵੀ ਉਹਨੂੰ ਸਰੀਰਕ ਤੌਰ 'ਤੇ ਕੋਈ ਵੀ ਬਿਮਾਰੀਆਂ ਨਾ ਹੋਣ ਹੈ ਨਾ ਤਾਂ ਉਹ ਵਧੀਆ ਡਾਂਸਰ ਬਣਦਾ ਉਹਦੇ ਹਾਵ ਭਾਵ ਵਧੀਆ ਹੋਣੇ ਚਾਹੀਦੇ ਆ ਆਈਜ ਦੇ ਲਿਪਸ ਦੇ ਲਿਪਸਿੰਗ ਵਗੈਰਾ ਉਹਨੂੰ ਬਹੁਤ ਸੋਹਣੀ ਆਉਣੀ ਚਾਹੀਦੀ ਆ ਹੈ ਨਾ ਵੀ ਉਹਦੇ ਵੀ ਜੋ ਲੋਕਾਂ ਨੂੰ ਆਪਦੇ ਕਨੀ ਅਟਰੈਕਟ ਕਰ ਸਕੇ ਇਹ ਇੱਕ ਚੰਗਾ ਡਾਂਸਰ ਬੰਦਾ ਇੱਦਾਂ ਹੀ ਬਣਦਾ ਥੈਂਕ ਯੂ